ਸਾਡੇ ਖੇਤਰ ਵਿੱਚ ਰਿਹਾਇਸ਼ ਅਤੇ ਆਵਾਜਾਈ ਦੇ ਢਾਂਚੇ ਬਹੁਤ ਹੀ ਵਧੀਆ ਹਨ ਲੋਕਾਂ ਦੇ ਰਹਿਣ ਰਿਹਾਇਸ਼ ਲਈ ਇੱਥੇ ਲੋਕਾਂ ਨੇ ਆਪਣੇ ਘਰਾਂ ਨੂੰ ਹੋਮ ਸਟੇਅ ਅਤੇ ਪੀ ਜੀ ਬਣਾ ਰੱਖੇ ਹਨ ਜਿੱਥੇ ਕਿ ਘਰਾਂ ਵਰਗਾ ਮਾਹੌਲ ਹੁੰਦਾ ਹੈ ਆਵਾਜਾਈ ਦੇ ਸਾਧਨ ਵੀ ਬਹੁਤ ਸਾਰੇ ਮੌਜੂਦ ਹਨ ਲੋਕਾਂ ਨੂੰ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਲਈ ਟੈਕਸੀ ਦੀ ਸੁਵਿਧਾ ਮਿਲ ਜਾਂਦੀ ਹੈ ਸਰਕਾਰੀ ਆਵਾਜਾਈਆਂ ਜਿੱਦਾਂ ਕਿ ਸਰਕਾਰੀ ਬੱਸਾਂ ਅਤੇ ਰੇਲ ਗੱਡੀਆਂ ਵੀ ਮੌਜੂਦ ਹਨ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਨਵੇਂ ਨਵੇਂ ਮਿਊਜ਼ੀਅਮ ਹਵੇਲੀਆਂ ਆਦਿ ਖੋਲ੍ਹਣੇ ਚਾਹੀਦੇ ਹਨ ਅਤੇ ਸਾਨੂੰ ਆਪਣੀਆਂ ਪੁਰਾਣੀ ਰਵਾਇਤੀ ਚੀਜ਼ਾਂ ਨੂੰ ਸਾਂਭ ਕੇ ਉਹਨਾਂ ਨੂੰ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ